ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਵਧੀਆ ਤੁਸੀਂ ਸੁਣਾਓ ਤੁਸੀਂ ਕੋਣ ਅੱਛਾ ਜੀ

ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲਿਆ ਵੈਸੇ ਤੁਹਾਡੇ ਦੋਸਤ ਦਾ ਨਾਮ ਤੁਹਾਡੇ ਦੋਸਤ ਦਾ ਕੀ ਨਾਮ ਆ ਅੱਛਾ ਸਤੀਸ਼ ਨੇ ਨੰਬਰ ਦਿੱਤਾ ਅੱਛਾ ਅੱਛਾ ਤੁਸੀਂ ਅੱਛਾ ਮੈਂ ਉਹਦੇ ਅੱਛਾ ਤੁਸੀਂ ਉਹਨੂੰ ਨੋਨ ਤੋਂ ਆਏ ਜਿਹੜੇ ਅੱਛਾ ਅੱਛਾ ਹਾਂ ਮੇਰੀ ਹਾਂ ਮੈਨੂੰ ਆ ਗਿਆ ਸੀ ਉਹਨਾਂ ਦਾ ਕਾਲ ਵੈਸੇ ਦੀਦੀ ਜੀ ਦਾ ਕਿ ਉਹ ਤਾਂ ਕਹਿੰਦੇ ਸੀ ਕਿ ਇਹ ਨਵੇਂ ਨਵੇਂ ਸਿਫਟ ਹੋਏ ਆ ਇਹ ਨਾ ਹੁਸ਼ਿਆਰਪੁਰ ਨਵੇਂ ਨਵੇਂ ਸ਼ਿਫਟ ਹੋਏ ਆ ਇਹਨਾਂ ਨੂੰ ਪੁੱਛਣਾ ਤੁਸੀਂ ਕਿੱਥੇ ਲਿਆ ਮੇਨ ਬੇਸਿਕਲੀ ਘਰ ਰੈਂਟ 'ਤੇ ਲੈਣਾ ਸੀ ਤੁਸੀਂ ਤੁਸੀਂ ਮਤਲਬ ਲੈਣਾ ਸੀ ਨਾ ਘਰ ਘੁਰ ਇੱਥੇ ਰੈਂਟ 'ਤੇ ਕਿੱਥੇ ਕੁ ਲਿਆ ਹੁਸ਼ਿਆਰਪੁਰ ਅੱਛਾ ਮਿਲ ਗਿਆ ਸੀ ਤੁਹਾਨੂੰ ਸਹੀ ਜੀ ਸਹੀ ਸਹੀ ਮਿਲ ਗਿਆ ਚਲੋ ਵਧੀਆ ਹੋਰ ਮਤਲਬ ਹਾਂ ਮਤਲਬ ਹੁਸ਼ਿਆਰਪੁਰ ਮਤਲਬ ਠੀਕ ਆ ਸੇਫੈਸਟ ਸਿਟੀ ਆ ਹੁਸ਼ਿਆਰਪੁਰ ਸਭ ਕੁਛ ਠੀਕ ਆ ਹੁਸ਼ਿਆਰਪੁਰ ਬਾਰੇ ਇੰਨਾ ਕੁਛ ਹੈ ਨਹੀਂ ਹਾਂ ਉਹ ਤਾਂ ਉਹ ਤਾਂ ਉਹ ਤਾਂ ਬੰਦੇ ਨੂੰ ਆਪ ਹੀ ਅਡੈਪਟ ਕਰਨਾ ਪੈਂਦਾ ਕੰਡਿਸ਼ਨਸ ਤੁਹਾਨੂੰ ਪਤਾ ਹੀ ਆ ਬੰਦੇ ਨੇ ਆਪ ਹੀ ਦੇਖਣਾ ਪੈਂਦਾ ਕਿ ਕੀ ਕਰਨਾ ਚਾਹੀਦਾ ਕੀ ਹੁਸ਼ਿਆਰਪੁਰ ਠੀਕ ਠੁੱਕ ਆ ਉਹ ਮੈਨੂੰ ਕਹਿ ਰਹਿ ਸੀ ਤੁਸੀਂ ਵੀਕਲ ਵਗੈਰਾ ਵੀ ਲੈਣਾ ਕੋਈ ਤਾਂ ਇੱਕ ਨਾ ਟਰੈਫਿਕ ਬਾਰੇ ਕਹਿ ਰਹੇ ਸੀ ਕੀ ਕਿਹੜਾ ਵੀਹਕਲ ਸੂਟ ਕਰੂਗਾ ਇੱਥੇ ਹੁਣ ਦੇਖੋ ਈ ਰਿਕਸ਼ਾ ਵੀ ਚੱਲਦੀਆਂ ਵਗੈਰਾ ਇਲੈਕਟਰੋਨਿਕ ਇਲੈਕਟਰੋਨਿਕ ਸਕੂਟਰ ਵਗੈਰਾ ਵੀ ਚੱਲਦੇ ਆ ਠੀਕ ਆ ਰੋਡ ਟਰੈਫਿਕ ਵੀ ਇਹ ਗੱਲ ਹੈ ਕਿ ਹੈਨਾ ਜਿਹੜੀ ਟਰੈਫਿਕ ਹੈ ਨਾ ਹੁਸ਼ਿਆਰਪੁਰ 'ਚ ਵੈਸੇ ਤਾਂ ਹੈਲਮਟ ਲੋਕ ਘੱਟ ਹੀ ਲਾਉਂਦੇ ਆ ਪਰ ਤੁਹਾਨੂੰ ਪਤਾ ਹੀ ਆ ਆਪਣੀ ਸੇਫਟੀ ਤਾਂ ਆਪ ਰੱਖਣੀ ਚਾਹੀਦੀ ਆ ਹਾਂ ਅਤੇ ਹਾਂ ਅਗਰ ਤੁਸੀਂ ਗੱਡੀ ਵਗੈਰਾ ਲੈਣੀ ਹੋਵੇ ਤੁਸੀਂ ਲੈ ਸਕਦੇ ਓ ਉਹ ਕਹਿੰਦੇ ਸੀ ਇਹਨਾਂ ਨੇ ਲੈਣਾ ਵਹੀਕਲ ਵਗੈਰਾ ਉੱਥੇ ਲੈ ਕੇ ਨਹੀਂ ਆਏ ਕੁਛ ਤਾਂ ਰੋਡ ਟ੍ਰੈਫਿਕ ਇਹ ਹੀ ਆ ਇੱਥੇ ਮੈਂ ਚੌਂਕਾਂ 'ਚ ਹੀ ਜ਼ਿਆਦਾ ਹੁੰਦਾ ਚਲਾਉਣ ਨੂੰ ਬਾਕੀ ਗਲੀਆਂ ਗੁਲੀਆਂ ਤਾਂ ਤੁਹਾਨੂੰ ਪਤਾ ਹੀ ਦੇਖ ਹੀ ਲਈਆਂ ਹੋਣੀ ਥੋੜ੍ਹੀ ਬਹੁਤੀ ਨਾ ਬਿਸਮਿਲਾ ਭਾਜੀ ਚੌਕ ਹਾਂ ਤੁਹਾਡਾ ਵੀ ਚੌਂਕ 'ਚ ਹੀ ਚੌਂਕ ਦੇ ਕੋਲ ਹੀ ਅੜਿਆ ਘਰ ਤੁਹਾਡਾ ਵੀ ਚੌਂਕ ਵਾਲੇ ਏਰੀਆ 'ਚ ਆ ਰਿਹਾ ਟਰੈਫਿਕ ਟਰੈਫਿਕ ਦੇ ਏਰੀਆ ਇਹ ਨਾ ਮੇਨ ਤੁਹਾਨੂੰ ਪਰਭਾਰ ਚੌਂਕ ਜ਼ਿਆਦਾ ਟਰੈਫਿਕ ਮਿਲੂਗਾ ਮੇਨ ਚੌਂਕਾਂ 'ਚ ਤੁਹਾਨੂੰ ਘੰਟਾ ਘਰ ਬਹੁਤ ਟ੍ਰੈਫਿਕ ਮਿਲੂਗਾ ਕਿਉਂਕਿ ਮਾਰਕੀਟ ਚਲਦੀ ਮਾਰਕੀਟ ਆ ਉੱਥੇ ਸਾਡੇ ਸਬਜ਼ੀ ਮੰਡੀ ਉੱਥੋਂ ਰਸਤਾ ਆਉਂਦਾ ਹੋਸ਼ਿਆਰਪੁਰ ਸਬਜ਼ੀ ਮੰਡੀ ਦਾ ਰਾਸਤਾ ਵੀ ਉਥੋਂ ਆਉਂਦਾ ਬਜਾਰ ਵਾਲਾ ਰਸਤਾ ਵੀ ਮੇਨ ਉੱਥੇ ਸੇਂਟਰ ਆ ਨਾ ਤਾਂ ਸਾਰੇ ਰਸਤੇ ਉੱਥੋਂ ਕਨੇਕਟਿਡ ਆ ਤਾਂ ਉਹ ਬਜ਼ਾਰ 'ਚ ਬਹੁਤ ਰਸ਼ ਹੁੰਦਾ ਤਾਂ ਬਹੁਤ ਰਸ਼ ਹੁੰਦਾ ਟਰੈਫਿਕ ਵੀ ਅਤੇ ਬਹੁਤ ਹੁੰਦਾ ਟ੍ਰੈਫਿਕ ਨਿਯਮਾਂ ਦਾ ਪਾਲਣ ਤਾਂ ਸਾਰੇ ਕਰਦੇ ਹੀ ਹੈ ਵੈਸੇ ਤਾਂ ਚਲਾਨ ਵਗੈਰਾ ਵੀ ਹੋਈ ਜਾਂਦੇ ਆ ਅ ਬਸ ਇਹ ਹੀ ਆ ਕਿ ਕਈ ਆ ਵੀ ਟ੍ਰੈਫਿਕ ਟ੍ਰੁਫਿਕ ਤੁਹਾਨੂੰ ਤੁਹਾਨੂੰ ਪਤਾ ਹੀ ਸ਼ਿਮਲਾਬਰੀ ਚੌਂਕ 'ਚ ਟ੍ਰੈਫਿਕ ਹੋਣਾ ਬੜੇ ਚੌਂਕ ਹਾਂ ਜਾਂ ਸ਼ਿਮਲਬਾਰੀ ਟੋਪ ਕੋਲ ਟ੍ਰੈਫਿਕ ਹੋਣਾ ਅਤੇ ਆਪੋ ਖੁਦ ਆਪਣੀ ਸੇਫਟੀ ਹੈ ਅਤੇ ਸਪੀਡ ਲਿਮਿਟ ਆਪ ਹੀ ਬੰਦੇ ਨੂੰ ਹੌਲੀ ਚਲਾਉਣੀ ਚਾਹੀਦੀ ਨਹੀਂ ਤੁਹਾਨੂੰ ਪਤਾ ਹੀ ਲੋਕ ਮੰਨਦੇ ਤਾਂ ਹੈ ਨਹੀਂ ਵੈਸੇ ਲੋਕ ਤੇਜ਼ ਚਲਾਉਣ ਲੱਗ ਪੈਂਦੇ ਆ ਆਪਣੇ ਵਾਸਤੇ ਆਪ ਹੀ ਐਕਸੀਡੈਂਟ ਹੋਣ ਦੇ ਚਾਨਸ ਆ ਉਹ ਹੁਣ ਵੈਸੇ ਟ੍ਰੈਫਿਕ ਰੁਲਸ ਤਾ ਪਾ ਹੈਗੀ ਸੇਫਟੀ ਤਾਂ ਹੈਗੀ ਸਾਰਾ ਕੁਛ ਸਹੀ ਆ ਇਵੇਂ ਡਰਨ ਦੀ ਕੋਈ ਗੱਲ ਨਹੀਂ ਆ ਤੁਹਾਡੇ ਤਾਂ ਤੁਹਾਡੇ ਤਾਂ ਚੌਂਕ ਦੇ ਨਾਲ ਹੀ ਪੁਲਿਸ ਖੜੀ ਹੋਣੀ ਹਾਂ ਬਸ ਤੇ ਇੱਕ ਬਸ ਸਟੈਂਡ ਵੱਲ ਵੀ ਥੋੜ੍ਹਾ ਰਸ਼ ਹੁੰਦਾ ਇੱਥੇ ਟਰੈਫ ਵਗੈਰਾ ਛੱਡ ਦਿਓ ਹੈਗਾ ਹੀ ਤੁਹਾਨੂੰ ਤਾਂ ਅੱਜ ਕੱਲ੍ਹ ਸਾਰੀ ਜਗ੍ਹਾ ਟਰੈਫਿਕ ਤਾਂ ਹੁੰਦੇ ਹੀ ਹੁੰਦਾ ਇੱਥੇ ਮੇਨ ਨਾ ਬਸ ਬਜ਼ਾਰਾਂ ਵਗੈਰਾ 'ਚ ਜ਼ਿਆਦਾ ਟ੍ਰੈਫਿਕ ਮਿਲਣਾ ਤੁਹਾਨੂੰ ਬਜ਼ਾਰਾਂ ਵਗੈਰਾ 'ਚ ਜ਼ਿਆਦਾ ਟਰੈਫਿਕ ਮਿਲਣਾ ਤੁਹਾਨੂੰ ਉਹ ਮੇਨ ਅਗਰ ਤੁਸੀਂ ਜਾਓਗੇ ਵਾਲੀ ਸਾਈਡ ਘੰਟਾ ਘਰ ਵਾਲੀ ਸਾਇਡ ਅਤੇ ਚੋਂਕ ਵਾਲੀ ਸਾਇਡ ਟਰੈਫਿਕ ਤਾਂ ਮਿਲਣਾ ਹੀ ਮਿਲਣਾ ਚੈਕਿੰਗ ਵਗੈਰਾ ਵੀ ਹੈਗੀ ਇੰਨੀ ਚੇਕਿੰਗ ਵਗੈਰਾ ਵੀ ਹੋ ਜਾਂਦੀ ਵਿੱਚ ਕਦੀ ਕਦੀ ਉਹ ਤਾਂ ਹੋਈ ਜਾਂਦੀ ਹੈ ਟ੍ਰੈਫਿਕ ਤਾਂ ਠੀਕ ਆ ਉਹ ਤਾਂ ਮੈਂ ਹੁਣ ਬੰਦਾ ਕਿੰਨਾ ਕੂਲਜ ਵਾਲੇ ਵੀ ਕਿੰਨਾ ਕੈਜ਼ ਰੋਕ ਲਵੇ ਬੰਦੇ ਨੂੰ ਆਪਣੀ ਸੇਫਟੀ ਦਾ ਧਿਆਨ ਆਪ ਹੀ ਰਖਣਾ ਪੈਣਾ ਹਾਂਜੀ ਇਹ ਹੀ ਆ ਬਸ ਹਾਂ ਜੀ ਕੋਈ ਨਹੀਂ ਨਹੀਂ ਨਹੀਂ ਇਹਦੇ 'ਚ ਕੋਈ ਗੱਲ ਨਹੀਂ ਕੱਲ੍ਹ ਈ ਅਗਰ ਲੋੜ ਪਈ ਤੁਸੀਂ ਮੈਨੂੰ ਫੋਨ ਕਰ ਲਿਓ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਵੈਲਕਮ ਜੀ ਵੈਲਕਮ ਓਕੇ ਜੀ